ਇੰਡੀਆ ਦੇ ਵਿੱਚ ਜਿਹੜਾ ਕਾਨੂੰਨ ਪ੍ਰਣਾਲੀ ਹੈ ਉਹ ਕਾਫੀ ਡਿਲੀ ਹੌਲੀ ਚਲਦੀ ਹੈ ਕਿਉਂਕਿ ਜਨਤਾ ਦੁਨੀਆਂ ਬਹੁਤ ਜ਼ਿਆਦਾ ਹੋ ਚੁੱਕੀ ਹੈ ਭਾਰਤ ਵਿੱਚ ਜਿਹਦੇ ਕਰਕੇ ਹਰ ਬੰਦਾ ਜਿਹੜਾ ਹੈ ਆਪਣੇ ਆਪ ਨੂੰ ਨਿਆਂ ਦਿਲਾਉਣਾ ਚਾਹੁੰਦਾ ਹਰ ਤਰੀਕੇ ਨਾਲ ਕਿਸੇ ਨਾ ਕਿਸੇ ਨਾਲ ਅਨਿਆਏ ਹੋਈ ਰਿਹਾ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋ ਰਿਹਾ ਹੋਵੇ ਬਟ ਉਂਝ ਹਰ ਕੋਈ ਕੇਸ ਜਿਹੜਾ ਆ ਉਹ ਕੋਰਟ ਦੇ ਵਿੱਚ ਚਲਾ ਜਾਏਗਾ ਅਤੇ ਕਾਨੂੰਨ ਪ੍ਰਣਾਲੀ ਜਿਹੜੀ ਹੈ ਉਹ ਉਹਨਾਂ ਨੂੰ ਨਿਆਂ ਜਿਹੜਾ ਨਹੀਂ ਦਿਲਾ ਪਾਏਗੀ ਅਗਰ ਆਪਾਂ ਇੱਕ ਸਰਵੇ ਦੇ ਅਕੋਰਡਿੰਗ ਦੇਖਿਆ ਜਾਏ ਦੇਖੀਏ ਤਾਂ ਪੰਦਰ੍ਹਾਂ ਸਤੰਬਰ ਦੋ ਹਜ਼ਾਰ ਇੱਕੀ ਨੂੰ ਚੈੱਕ ਕੀਤਾ ਗਿਆ ਸੀਗਾ ਅਤੇ ਚਾਰ ਪੁਆਇੰਟ ਪੰਜ ਕਰੋੜ ਪੈਂਡਿੰਗ ਕੇਸ ਸੀਗੇ ਇੰਡੀਆ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਜਿਹੜਾ ਡਾਟਾ ਆ ਹੋਰ ਵਧਦਾ ਗਿਆ ਇਸ ਲਈ ਉਹਨਾਂ ਨੇ ਫਿਰ ਇੱਕ ਛੋਟਾ ਜਿਹਾ ਇੱਕ ਲੋਕ ਅਦਾਲਤਾਂ ਬਣਾਈਆਂ ਜਿਹਦੇ ਵਿੱਚ ਕਿ ਛੋਟੇ ਮੋਟੇ ਜਿਹੜੇ ਕੇਸ ਹੈਗੇ ਆ ਉਹ ਬਾਹਰ ਹੀ ਸੋਲਵ ਕਰ ਲਏ ਜਾਣ ਤਾਂ ਕਿ ਹਰ ਇੱਕ ਜਿਹੜਾ ਆ ਉਹ ਕੇਸ ਜਿਹੜਾ ਆ ਕੋਰਟ ਵਿੱਚ ਨਾ ਜਾ ਕੇ ਬਹੁਤ ਜ਼ਿਆਦਾ ਪੈਂਡਿੰਗ ਫਾਈਲਾਂ ਜਿਹੜੀਆਂ ਹੋ ਚੁੱਕੀਆਂ ਸੀ ਜਿਹੜੀ ਬੈਕ ਲੋਕ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ ਇਸ ਕਰਕੇ ਉਹਨਾਂ ਨੂੰ ਸੀਗਾ ਕਿ ਇੱਕ ਲੋਕ ਅਦਾਲਤਾਂ ਬਣਾ ਲਈਆ ਜਾਣ ਤਾਂ ਕਿ ਜਿਹੜੇ ਛੋਟੇ ਮੋਟੇ ਕੇਸ ਆ ਲੋਕਾਂ 'ਤੇ ਉਹ ਬਾਹਰ ਹੀ ਸੋਲਵ ਕਰ ਲਏ ਜਾਣ ਲੋਕ ਅਦਾਲਤਾਂ ਲਈ ਫੋਰਟੀ ਸੈਕਿੰਡ ਅਮੈਂਡਮੈਂਟ ਕੀਤੀ ਗਈ ਬਤਾਲੀਵੀਂ ਅਮੈਂਡਮੈਂਟ ਸੀਗੀ ਜਿਹਦੇ ਵਿੱਚ ਕਿ ਉਨਤਾਲੀ ਏ ਆਰਟੀਕਲ ਇੰਟਰੋਡਿਊਸ ਕੀਤਾ ਗਿਆ ਸੀਗਾ ਜਿਹਦੇ ਵਿੱਚ ਲੋਕ ਅਦਾਲਤਾਂ ਬਣਾਈਆਂ ਗਈਆਂ ਸੀ ਤਾਂ ਕਿ ਜਿਹੜੇ ਬੈਕ ਲੋਕ ਦੇ ਉਹ ਕੇਸ ਹੈਗੇ ਆ ਜਾਂ ਫਿਰ ਜਿਹੜੇ ਛੋਟੇ ਮੋਟੇ ਕੇਸ ਆ ਉਹ ਬਾਹਰ ਹੀ ਨਿਪਟਾ ਲਏ ਜਾਣ